ਫੁੱਲ ਬੂਟੇ ਵੇਲ੍ਹਾਂ ਸਬਜ਼ੀਆਂ ਅਤੇ ਇਹਨਾਂ ਦੀ ਸਾਂਭ ਸੰਭਾਲ ਗਰਮੀਆਂ ਦੇ ਵਿੱਚ ਨਾ ਗਰਮੀਆਂ ਦੇ ਵਿੱਚ ਇਹਨੂੰ ਗਰਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਭਾਵ ਕਹਿਣ ਦਾ ਕਿ ਇਹਨਾਂ ਦੀ ਜਿਹੜੀ ਦੇਖ ਸੰਭਾਲ ਹੈ ਬੂਟਿਆਂ ਦੀ ਇਹਨੂੰ ਟਾਈਮ 'ਤੇ ਪਾਣੀ ਦੇਣਾ ਚਾਹੀਦਾ ਬੂਟਿਆਂ ਦੇ ਵਿੱਚ ਟਾਕ ਹੋ ਜਾਂਦੇ ਨਦੀਨ ਹੋ ਜਾਂਦੇ ਆ ਉਹਨਾਂ ਨੂੰ ਟਾਈਮ 'ਤੇ ਕੱਢਣਾ ਚਾਹੀਦਾ ਅਤੇ ਸਰਦੀਆਂ ਦੇ ਵਿੱਚ ਵੀ ਇਹਨੂੰ ਭਾਵ ਮੌਸਮ ਦੇ ਹਿਸਾਬ ਨਾਲ ਇਹਨੂੰ ਬਚਾਉਣਾ ਚਾਹੀਦਾ ਬੂਟਿਆਂ ਨੂੰ ਅਤੇ ਸਬਜ਼ੀਆਂ ਨੇ ਵੇਲ੍ਹਾਂ ਨੇ ਅਤੇ ਹੋਰ ਫੁੱਲਾਂ ਵਾਲੇ ਬੂਟੇ ਨੇ ਇਹਨਾਂ ਦੀ ਸਾਂਭ ਸੰਭਾਲ ਸਾਨੂੰ ਹਰ ਸਮੇਂ ਕਰਨੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਅਤੇ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਜ਼ਿਆਦਾ ਕਿਉਂਕਿ ਗਰਮੀ ਜ਼ਿਆਦਾ ਪੈਣ ਕਾਰਨ ਦੇ ਜ਼ਿਆਦਾ ਬੂਟੇ ਉਹ ਮੱਚ ਜਾਂਦੇ ਆ ਅਤੇ ਜੇ ਇਹਨਾਂ ਨੂੰ ਪਾਣੀ ਵੀ ਟਾਈਮ 'ਤੇ ਲਾਉਣਾ ਚਾਹੀਦਾ ਕਿਉਂਕਿ ਪਾਣੀ ਨਹੀਂ ਲਾਵਾਂਗੇ ਤਾਂ ਬੂਟੇ ਮੱਚ ਜਾਣਗੇ ਅਤੇ ਕੱਖ ਨਦੀਨੇ 'ਚੋਂ ਕੱਢ ਦੇਣੇ ਚਾਹੀਦੇ ਆ ਭਾਵ ਕਈ ਵਾਰੀ ਇਹਨਾਂ ਨੂੰ ਕੱਖ ਨਦੀਨ ਨਹੀਂ ਕੱਢਾਂਗੇ ਤਾਂ ਸੁੰਡੀ ਪੈ ਜਾਂਦੀ ਆ ਫਿਰ ਤਾਂ ਉਹ ਸੁੰਡੀ ਪੈ ਗਈ ਤਾਂ ਉਹ 'ਤੇ ਸਾਨੂੰ ਸਪਰੇਅ ਵੀ ਕਰਨੀ ਚਾਹੀਦੀ ਆ ਇਸ ਕਰਕੇ ਇਹਨੂੰ ਪੌਦਿਆਂ ਨੂੰ ਫੁੱਲ ਬੂਟਿਆਂ ਨੂੰ ਸਮੇਂ ਸਿਰ ਇਹਦੀ ਸੰਭਾਲ ਕੀਤੀ ਜਾਵੇ ਤਾਂ ਜੋ ਇਹ ਸੋਹਣੇ ਲੱਗਣੇ ਸ਼ੁਰੂ ਹੋ ਜਾਣ ਧੰਨਵਾਦ